ਜੀ ਮੈਂ ਇੱਕ ਹੀ ਸੁਝਾਵ ਦੇਣ ਦੇਣਾ ਚਾਹਵਾਂਗੀ ਜੋ ਹਜੇ ਸ਼ੁਰੂ ਕਰ ਰਿਹਾ ਹੈ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਸਥਾਪਿਤ ਰੋਕ ਗਾਰਡਨ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਉਹਦੇ ਵਿੱਚ ਕਿੰਨੀ ਸੋਹਣੇ ਤਰੀਕੇ ਨਾਲ ਮੂਰਤੀ ਬਣਾਏ ਹੋਏ ਹਨ ਅਤੇ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਇੱਕ ਉਹ ਵੀ ਤਾਂ ਪੱਥਰ ਹੀ ਹੈ ਮੈਂ ਬਸ ਇੰਨਾ ਹੀ ਕਹਿਣਾ ਚਾਹਵਾਂਗੀ ਕਿ ਤੁਸੀਂ ਅਗਰ ਕੁਝ ਇਕੱਠਾ ਕਰਨ ਦਾ ਸੋਚਿਆ ਤਾਂ ਉਹਨੂੰ ਹੋ ਸਕੇ ਤਾਂ ਇੱਕ ਨਏ ਆਰਟਵਰਕ ਦੇ ਵਿੱਚ ਬਦਲੋ ਆਪਣੀ ਜੋ ਸੋਚਣ ਦੀ ਸ਼ਕਤੀ ਹੈ ਉਹਨਾਂ ਨੂੰ ਬੜਾਓ ਅਤੇ ਹੋ ਸਕੇ ਤਾਂ ਉਹਨੂੰ ਇੱਕ ਨਯਾਂ ਆਕਾਰ ਦਓ ਪੱਥਰ ਪੱਥਰਾਂ ਤੋਂ ਹੀ ਤਾਂ ਘਰ ਬਣਦੇ ਹਨ ਅਤੇ ਉਹ ਪੱਥਰ ਕੀ ਸਾਡੇ ਘਰ ਨੂੰ ਸਜਾ ਨੀ ਸਕਦੇ ਤਾਂ ਮੈਂ ਬਸ ਇੱਕ ਹੀ ਸੁਝਾਅ ਦੇਣਾ ਚਾਹੁੰਗੀ ਕਿ ਤੁਸੀਂ ਅਗਰ ਕੁਝ ਇਕੱਠਾ ਕਰ ਕੁਝ ਵੀ ਇਕੱਠਾ ਕਰ ਰਹੇ ਹੋ ਨਾ ਹੀ ਪੱਥਰ ਨੂੰ ਨਾ ਦੇਖੋ ਕੁਝ ਵੀ ਇਕੱਠਾ ਕਰ ਰਹੇ ਹੋ ਉਹਨਾਂ ਨੂੰ ਕੁਝ ਨ ਨਵਾਂ ਬਣਾਓ ਓਹ ਓਹ ਆਪਣੇ ਜਿਸ ਜਿਸ 'ਤੇ ਤੁਹਾਡੇ ਸੋਚਣ ਦੀ ਸ਼ਕਤੀ ਅਤੇ ਤੁਹਾਡੀ ਕਲਾ ਦਾ ਇੱਕ ਨਯਾਂ ਰੂਪ ਤੁਹਾਨੂੰ ਖੁਦ ਦਿਖੇਗਾ ਅਤੇ ਨਿਖਰੇਗਾ ਕੁਛ ਤੁਹਾਡੇ ਲਈ ਹੀ ਉਹ ਅੱਛਾ ਰਹੇਗਾ ਤੁਹਾਡਾ ਘਰ ਸੁੰਦਰ ਹੋਵੇਗਾ ਅਤੇ ਪੱਥਰਾਂ ਮੈਂ ਪੱਥਰਾਂ ਕ ਦਾ ਕੰਮ ਉਹਨਾਂ ਨੂੰ ਜੋੜ ਜੋੜ ਕੇ ਇੱਕ ਨਯਾਂ ਆਕਾਰ ਦਾ ਕਰਦੀ ਹਾਂ ਤੁਸੀਂ ਵੀ ਉਹ ਸ ਉਹ ਉਹ ਤੁਸੀਂ ਵੀ ਉਹੀ ਕਰੋ ਇੱਕ ਆਰਟਵਰਕ ਇੱਕ ਨਯਾ ਨਈ ਚੀਜ਼ ਨੂੰ ਆਕਾਰ ਦਓ